ਮੈਂ ਪਹਿਲਾਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਫੇਰ ਨੌਕਰੀ ਦੀ ਭਾਲ ਕਰਨ ਕੀਤੀ ਤਾਂ ਫੇਰ ਮੈਨੂੰ ਜਾ ਕੇ ਆਈ ਆਈ ਟੀ ਵਿੱਚ ਛੋਟੇ ਲੈਵਲ 'ਚ ਨੌਕਰੀ ਮਿਲੀ ਫੇਰ ਮੇਰੇ ਕੰਮ ਦੀ ਲਗਨ ਦੇਖ ਕੇ ਸਰ ਨੇ ਮੈਨੂੰ ਲੈਬ ਅਟੈਨਡੈਂਟ ਵਿੱਚ ਰੱਖ ਲਿਆ ਅਤੇ ਹੁਣ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹਾਂ ਅਤੇ ਮੈਨੂੰ ਆਸ ਹੈ ਕਿ ਮੈਂ ਆਪਣੇ ਗਾਹਾਂ ਦੀ ਹੋਰ ਤਰੱਕੀ ਕਰੂੰਗਾ